ਪੰਜਾਬ ਵਿੱਚ ਲੋਕ ਆਪਣੇ ਸੱਭਿਆਚਾਰਕ ਵਿਰਾਸਤ ਨੂੰ ਤੀਆਂ ਦੇ ਤਿਉਹਾਰ ਨਾਲ਼ ਮਨਾਉਂਦੇ ਹਨ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਤੀਆਂ ਦੇ ਤਿਉਹਾਰ ਵਿੱਚ ਕੁੜੀਆਂ ਗਿੱਧਾ ਅਤੇ ਭੰਗੜਾ ਪਾ ਕੇ ਇਸਨੂੰ ਮਨਾਉਂਦੀਆਂ ਹਨ ਅਤੇ ਕੁੜੀਆਂ ਇਸ ਦਿਨ ਬਹੁਤ ਸੋਹਣੀਆਂ ਤਿਆਰ ਹੁੰਦੀਆਂ ਹਨ ਅਤੇ ਇਸ ਦਿਨ ਉਹ ਸੱਗੀ ਫੁੱਲ ਫੁਲਕਾਰੀ ਪੰਜਾਬੀ ਜੁੱਤੀ ਪਰਾਂਦੀ ਸੂਟ ਲਹਿੰਗੇ ਇਹ ਸਭ ਕੁਝ ਪਾ ਕੇ ਇਸ ਇਸ ਤਿਉਹਾਰ ਨੂੰ ਹੋਰ ਵੀ ਵਧੀਆ ਬਣਾਉਂਦੀਆਂ ਹਨ ਅਤੇ ਇਸ ਦਿਨ ਉਹ ਖੀਰ ਪੂੜੇ ਬਣਾ ਕੇ ਇਸਨੂੰ ਹੋਰ ਵੀ ਜ਼ਿਆਦਾ ਖੁਸ਼ੀ ਨਾਲ ਮਨਾਉਂਦੀਆਂ ਹਨ